ਕ ਕੈਮਰਾ ਖਰੀਦਣ ਵਿੱਚ ਦਿਲਚਸਪੀ ਰੱਖਦੀ ਹਾਂ ਮੈਂ ਪਹਿਲਾਂ ਵਧੀਆ ਐਪ ਦੇਖਾਂਗੀ ਜਿੱਥੇ ਵਧੀਆ ਚੀਜ਼ਾਂ ਮਿਲਦੀਆਂ ਹੋਣ ਮੈਂ ਜਿਹੜੇ ਕੈਮਰਾ ਲੈਣਾ ਚਾਹੁੰਦੀ ਹਾਂ ਉਹਦੀ ਵਿਸ਼ੇਸ਼ਤਾ ਦੇਖਾਂਗੀ ਲੋਕਾਂ ਦੇ ਰਿਵਿਊ ਚੈੱਕ ਕਰਕੇ ਫਿਰ ਮੈਂ ਜਿਹੜਾ ਸਸਤਾ ਮਿਲੇਗਾ ਮੇਰੀ ਪੋਕਟ ਦੇ ਮੁਤਾਬਿਕ ਉਹ ਲਵਾਂਗੀ ਜੋ ਮੈਨੂੰ ਸੈੱਟ ਬੈਠੇਗਾ ਔਰ ਜੋ ਮੇਰੇ ਘਰਦਿਆਂ ਨੂੰ ਪਸੰਦ ਹੋਵੇਗਾ ਜੋ ਮੇਰੇ ਬੇਟੇ ਨੂੰ ਪਸੰਦ ਹੋਵੇਗਾ